ਹੈਲੋ ਉਹ ਤੁਸੀਂ ਕ੍ਰਿਸ਼ਨਾ ਵੈਜੀਟੇਬਲ ਸ਼ੋਪ ਤੋਂ ਗੱਲ ਕਰ ਰਹੇ ਹੋ ਅੱਛਾ ਨਮਸਤੇ ਆਂਟੀ ਜੀ ਹੋਰ ਕਿਵੇਂ ਹੋ ਹਾਂਜੀ ਉਹ ਨਾ ਮੈਂ ਸਬਜ਼ੀਆਂ ਲੈਣੀਆਂ ਸੀ ਤਾਂ ਕੀ ਕੁਛ ਹੈਗਾ ਤੁਹਾਡੇ ਕੋਲ ਕੀ ਕੁਛ ਹੈ ਮੈਂ ਨਾ ਔਰਗੈਨਿਕ ਮਤਲਬ ਕਿ ਬਿਨਾਂ ਖਾਦ ਵਾਲੀਆਂ ਸਬਜ਼ੀਆਂ ਕਿਹੜੀਆਂ ਕਿਹੜੀਆਂ ਹੈਗੀਆਂ ਤੁਹਾਡੇ ਕੋਲ

ਹਾਂਜੀ ਅੱਛਾ ਬੈਂਗਣ ਹੈਗੇ ਹੈ ਅੱਛਾ ਠੀਕ ਹੈ ਅਤੇ ਇਸ ਤੋਂ ਬਿਨਾਂ ਕਿਹੜੀਆਂ ਸਬਜ਼ੀਆਂ ਹੈਗੀਆਂ ਤੁਹਾਡੇ ਕੋਲ ਉਹ ਨਾ ਅੱਜ ਸਮਝ ਨਹੀਂ ਆ ਰਿਹਾ ਕੀ ਬਣਾਈਏ ਅਤੇ ਮੈਂ ਸੋਚਦੀ ਹਾਂ ਉਹਨਾਂ ਨੂੰ ਪੁੱਛ ਹੀ ਲੈਂਦੀ ਹਾਂ ਜੋ ਕੁਛ ਹੋਏਗਾ ਉਹਦੇ 'ਚ ਇੱਕ ਸਲੈਕਟ ਕਰਕੇ ਤਾਂ ਬਣਾ ਲਵਾਂਗੇ ਹਾਂਜੀ ਹਾਂ ਹਾਂਜੀ ਇਹ ਤਾਂ ਵਧੀਆ ਵੈਸੇ ਅਤੇ ਸ਼ਲਗਮ ਮਿੱਠੇ ਹੋਣੇ ਸ਼ੁਰੂ ਹੋ ਗਏ ਅੱਛਾ ਅਤੇ ਕੀ ਰੇਟ ਲਾਇਆ ਸਬਜ਼ੀ ਦਾ ਗਾਜਰਾਂ ਹੈਗੀਆਂ ਗਾਜਰਾਂ ਗਾਜਰਾਂ ਔਰਗੈਨਿਕ ਹੈ ਕਿ ਖਾਦ ਵਾਲੀ ਹੈ ਅੱਛਾ ਠੀਕ ਹੈ ਅਤੇ ਮਟਰ ਮਟਰ ਹੈਗੀ ਹੈ ਅਤੇ ਉਹ ਕਿਵੇਂ ਹੈ ਅੱਛਾ ਅੱਛਾ ਮਟਰ ਮਹਿੰਗੇ ਨਹੀਂ ਹੈਗੀ ਅੱਛਾ ਹਾਂ ਕੁਛ ਨਾ ਫਿਰ ਬਿਨਾਂ ਖਾਦ ਕਰਕੇ ਤੁਹਾਨੂੰ ਪਤਾ ਮਹਿੰਗੀਆਂ ਚਲੋ ਮਾੜਾ ਮੋਟਾ ਹੁੰਦੀਆਂ ਹੈ ਚਲੋ

ਅੱਛਾ ਹਾਂਜੀ ਇਹ ਤਾਂ ਹੈ ਅੱਛਾ ਤੁਹਾਡੇ ਕੋਲ ਇਕੱਲੀ ਸੀਜ਼ਨ ਦੀਆਂ ਸਬਜ਼ੀਆਂ ਮਿਲਦੀਆਂ ਹੈ ਕਿ ਕੋਈ ਗਰਮੀ ਦੀ ਵੀ ਕੋਈ ਸਬਜ਼ੀ ਮਿਲ ਜਾਂਦੀ ਹੈ ਅੱਛਾ ਕਟਾਰ ਦੀ ਸਬਜ਼ੀ ਮਿਲ ਜਾਏਗੀ ਤੁਹਾਡੇ ਕੋਲ ਅੱਛਾ ਫਿਰ ਚਲੋ ਕਟਾਰ ਤਾਂ ਚਿਕਨ ਆਪਾਂ ਐਵੇਂ ਕਰਦੇ ਹਾਂ ਤੁਸੀਂ ਇੱਕ ਕਿਲੋ ਗਾਜਰ ਅਤੇ ਅੱਧਾ ਕਿਲੋ ਮਟਰ ਉਹ ਪੈਕ ਕਰ ਦਿਓ ਜੀ ਅਤੇ ਹਾਂਜੀ ਹਾਂਜੀ ਮੂਲੀ ਵੀ ਠੀਕ ਰਹੇਗੀ ਨਾਲ ਸਲਾਦ ਲਈ ਸਹੀ ਰਹਿੰਦੀ ਹੈ ਅਤੇ ਗਾਜਰ ਦਾ ਕੀ ਰੇਟ ਲਾਇਆ ਤੁਸੀਂ ਗਾਜਰ ਦਾ ਕੀ ਰੇਟ ਲਾਇਆ ਅੱਛਾ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ